ਹਾਂਜੀ ਮੈਂ ਸਕੂਲ ਵਿੱਚ ਪੜ੍ਹਦੇ ਸਮੇਂ ਡਰਾਇੰਗ ਰੱਖੀ ਹੋਈ ਸੀ ਸਾਡੇ ਸਕੂਲ ਵਿੱਚ ਡਰਾਇੰਗ ਦਾ ਰੋਜ਼ ਇੱਕ ਪੀਰੀਅਡ ਲੱਗਦਾ ਸੀ ਜਿਸ ਵਿੱਚ ਸਾਡਾ ਸਾਡਾ ਸਕੂਲ ਮਾਸਟਰ ਸਾਨੂੰ ਡਰਾਇੰਗ ਸਿਖਾਇਆ ਕਰਦਾ ਸੀ ਜਿਵੇਂ ਕਿ ਉਸ ਨੇ ਸਾਨੂੰ ਦਰਖੱਤ ਦੀ ਫੋਟੋ ਕਹਿਣਾ ਵੀ ਉਹ ਦਰਖੱਤ ਦੀ ਫੋਟੋ ਬਣਾਓ ਜਾਂ ਸਾਨੂੰ ਕੋਈ ਤਸਵੀਰ ਦੇ ਦੇਣੀ ਵੀ ਇਹ ਬਣਾਓ ਉਹਦੇ ਵਿੱਚ ਮੇਰੀ ਰੁਚੀ ਬਹੁਤ ਸੀ ਮੈਂ ਅੱਛਾ ਮੈਂ ਅੱਛੀ ਬਣਾਇਆ ਕਰਦਾ ਸੀ ਫਿਰ ਸਾਡੇ ਮਾਸਟਰ ਜੀ ਸਾਨੂੰ ਕਦੀ ਕਦੀ ਸਾਨੂੰ ਉਹਨਾਂ ਨੇ ਗੂੱਡ ਵੀ ਦੇਣਾ ਜਾਂ ਸਟਾਰ ਦੇਣਾ ਸਾਨੂੰ ਅਤੇ ਮੈਨੂੰ ਬਹੁਤ ਦਿਲਚਸਪੀ ਸੀ ਡਰਾਇੰਗ ਵਿੱਚ ਹੌਲੀ ਹੌਲੀ ਮੈਂ ਪੜ੍ਹਦਾ ਪੜ੍ਹਦਾ ਕਾਲਜ ਵਿੱਚ ਗਿਆ ਕਾਲਜ ਵਿੱਚ ਮੈਂ ਇਸਦਾ ਕੋਰਸ ਫਿਰ ਉੱਥੇ ਆਪਸ਼ਨ ਆਈ ਵੀ ਤੁਸੀਂ ਕੀ ਕੀ ਕਰਨਾ ਫਿਰ ਮੈਂ ਉੱਥੇ ਵੀ ਆਪਣੇ ਕੈਰੀਅਰ ਵਾਸਤੇ ਡਰਾਇੰਗ ਹੀ ਰੱਖੀ ਡਰਾਇੰਗ ਮਤਲਬ ਕਾਲਜ ਸਕੂਲ ਵਿੱਚ ਡਰਾਇੰਗ ਸੀ ਕਾਲਜ ਵਿੱਚ ਜਾ ਕੇ ਇਹ ਆਰਟ ਐਂਡ ਕਰਾਫਟ ਦਾ ਕੋਰਸ ਬਣ ਗਿਆ ਜੋ ਕਿ ਦੋ ਸਾਲ ਦਾ ਹੁੰਦਾ ਹੈ ਦੋ ਸਾਲ ਦਾ ਉੱਥੇ ਮੈਨੂੰ ਸਿੱਖਣ ਨੂੰ ਬਹੁਤ ਕੁੱਝ ਮਿਲਿਆ ਬਹੁਤ ਕੁੱਝ ਮਿਲਿਆ ਕਾਫ਼ੀ ਕੁੱਝ ਸਿਖਿਆ ਮੈਂ ਉੱਥੇ ਕਰਦੇ ਕਰਾਉਂਦੇ ਅੱਗੇ ਜਿਵੇਂ ਫਿਰ ਜਿੱਦਾਂ ਲੋਕਲ ਜਿੱਦਾਂ ਮੇਰੀ ਡਰਾਇੰਗ ਚੰਗੀ ਸੀ ਲੋਕਲ ਮੇਰੇ ਕੋਲ ਮੇਰੇ ਉੱਥੇ ਅ ਪ੍ਰੋਫੈਸਰ ਨੇ ਮੈਨੂੰ ਕੰਮ ਦੇਣਾ ਸ਼ੁਰੂ ਕਰ ਦਿੱਤਾ ਜਿਵੇਂ ਕਿ ਕਿਸੇ ਕੁਇਨਸ ਘਰ ਦਾ ਨਕਸ਼ਾ ਬਣਾਉਣਾ ਜਾਂ ਕਿਸੇ ਪਾਰਕ ਦਾ ਨਕਸ਼ਾ ਬਣਾਉਣਾ ਜਾਂ ਕੋਈ ਸਰਕਾਰੀ ਸੀ ਚੀਜ਼ ਦਾ ਕੁੱਝ ਵੀ ਕੁੱਝ ਵੀ ਜਾਂ ਲਾ ਲੋ ਜਾਂ ਸੀਵਰੇਜ਼ ਦਾ ਜਾਂ ਕਿੱਦਾ ਇੱਦਾ ਦੇ ਮੇਰੇ ਪ੍ਰੋਫੈਸਰ ਮੈਨੂੰ ਦੇਣ ਲੱਗ ਗਏ ਮੈਂ ਬਹੁਤ ਜ਼ਿਆਦਾ ਉੱਥੇ ਕੰਮ ਕੀਤਾ ਫਿਰ ਮੇਰਾ ਇਹ ਪ੍ਰੋਫੈਸ਼ਨਲ ਹੌਲੀ ਹੌਲੀ ਮੇਰੀ ਜੌਬ ਦੇ ਵਿੱਚ ਕਨਵਰਟ ਹੋ ਗਿਆ ਜਿਵੇਂ ਫਿਰ ਮੈਂ ਬਾਅਦ ਵਿੱਚ ਜਦੋਂ ਆਪਣੀ ਕੋਰਸ ਕਰ ਲਿਆ ਉਸ ਤੋਂ ਬਾਅਦ ਮੈਂ ਆਪਣੇ ਇੱਥੇ ਰੋਪੜ ਵਿੱਚ ਹੀ ਇਹ ਕੰਮ ਆਪਣੀ ਦੁਕਾਨ ਖੋਲ੍ਹੀ ਉੱਥੇ ਨਕਸ਼ੇ ਬਣਾਏ ਲੋਕਾਂ ਦੇ ਕਾਫ਼ੀ ਮੈਨੂੰ ਇਸ ਨੇ ਮੇਰਾ ਘਰ ਚਲਾਉਣ ਵਿੱਚ ਵੀ ਮੇਰਾ ਸਹਾਈ ਹੋਇਆ ਸਹਾਈ ਹੋਇਆ ਹੁਣ ਮੈਂ ਬਹੁਤ ਵਧੀਆ ਹਾਂ ਮੈਂ ਹੁਣ ਸੋਚਦਾ ਹਾਂ ਕੀ ਇਹ ਜੋ ਡਰਾਇੰਗ ਜੋ ਚਿੱਤਰਕਾਰੀ ਜੋ ਕਲਾਕਾਰੀ ਮੈਂ ਆਪਣਾ ਏਮ ਬਣਾਇਆ ਸੀ ਮੇਰਾ ਡਿਸਿਜ਼ਨ ਸਹੀ ਸੀ ਪਰ ਹੁਣ ਮੈਂ ਸੋਚਦਾ ਹਾਂ ਕਿ ਇਹ ਮੈਂ ਬਾਹਰ ਦੇਸ਼ਾਂ ਪਰਦੇਸਾਂ ਵਿੱਚ ਵੀ ਜਾ ਕੇ ਇਸ ਕਲਾ ਨੂੰ ਵਧੀਆ ਕਰਾਂ ਵਧੀਆ ਮਤਲਬ ਹੁਣ ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਯੂਟਿਊਬ 'ਤੇ ਤੁਸੀਂ ਲਾ ਲੋ ਨਵੀਂ ਨਵੀਆਂ ਚੀਜ਼ਾਂ ਉੱਥੇ ਸਿੱਖਣ ਨੂੰ ਬਹੁਤ ਕੁੱਝ ਮਿਲਦਾ ਹੈ ਹੁਣ ਮੈਂ ਇਹੀ ਚਾਹੁੰਦਾ ਹਾਂ ਕਿ ਮੈਂ ਦੇਸਾਂ ਪਰਦੇਸਾਂ ਵਿੱਚ ਜਾ ਕੇ ਆਪਣੇ ਇਸ ਚਿੱਤਰਕਾਰੀ ਦੀ ਕਲਾ ਨੂੰ ਪ੍ਰਫੁੱਲਿਤ ਕਰਾਂ